ਬੱਚੇ 'ਤੇ ਤਕਨਾਲੋਜੀ ਦੇ ਕਾਫੀ ਨੁਕਸਾਨ ਹਨ ਜਿਵੇਂ ਕਿ ਮੋਬਾਇਲ ਦੀ ਜ਼ਿਆਦਾ ਵਰਤੋਂ ਕਰਨੀ ਬੱਚਿਆ ਦੀਆਂ ਅੱਖਾਂ 'ਤੇ ਬੁਰਾ ਪ੍ਰਭਾਵ ਪਾ ਰਹੀ ਹੈ ਉਹਨਾਂ ਦੇ ਦਿਮਾਗ ਵੀ ਜਿਹੜਾ ਆ ਉਹ ਉਸੇ ਤਰ੍ਹਾਂ ਦਾ ਵਰਕ ਕਰਦਾ ਸਾਰਾ ਦਿਨ ਉਹਨਾਂ ਦੇ ਦਿਮਾਗ 'ਤੇ ਮੋਬਾਇਲ ਵਿੱਚ ਖੇਡੀਆਂ ਗੇਮਾਂ ਮੋਬਾਇਲ ਵਿੱਚ ਵੇਖੀਆਂ ਵੀਡੀਓ ਅਤੇ ਗੱਲਾਂ ਬਾਤਾਂ ਹੀ ਚੱਲਦੀਆਂ ਰਹਿੰਦੀਆਂ ਹਨ ਉਹਨਾਂ ਦੇ ਦਿਮਾਗ 'ਚ ਕੋਈ ਹੋਰ ਨਵੀਂ ਸੋਚ ਪੈਦਾ ਨਹੀਂ ਹੁੰਦੀ ਉਹ ਫਿਰ ਇੱਕ ਲਕੀਰ ਦੇ ਫਕੀਰ ਹੀ ਬਣ ਜਾਣਗੇ ਸਾਨੂੰ ਤਕਨਾਲੋਜੀ ਦਾ ਜ਼ਿਆਦਾ ਵਰਤੋਂ ਜਿਹੜੀ ਉਹ ਬੱਚਿਆਂ ਨੂੰ ਨਹੀਂ ਕਰਨ ਦੇਣੀ ਚਾਹੀਦੀ ਅਤੇ ਜਿਹੜੀ ਹੈ ਏਜ ਐਪਰੋਪ੍ਰੀਏਟ ਬੱਚਿਆਂ ਨੂੰ ਜਿਹੜਾ ਆ ਉਹ ਕੁਝ ਵੀ ਵੇਖਣ ਦੇਣਾ ਚਾਹੀਦਾ ਇਸ ਤੋਂ ਦੇਖਭਾਲ ਕਰਨ ਦਾ ਇੱਕ ਤਰੀਕਾ ਇਹ ਹੈ ਕਿ ਜਦੋਂ ਵੀ ਬੱਚਾ ਮੋਬਾਈਲ ਫੜੇ ਮੋਬਾਇਲ ਦੀ ਵਰਤੋਂ ਕਰੇ ਉਦੋਂ ਉਹ ਪੇ ਆਪਣੇ ਮਾਪਿਆਂ ਦੀ ਨਿਗਰਾਨੀ ਹੇਠ ਹੋਣਾ ਚਾਹੀਦਾ ਮਾਂ ਪਿਓ ਨੂੰ ਵੇਖਣਾ ਚਾਹੀਦਾ ਕਿ ਬੱਚਾ ਜਿਹੜਾ ਉਹ ਕੀ ਵੇਖ ਰਿਹਾ ਹੈ ਯੂਟਿਊਬ 'ਤੇ ਕੋਈ ਗਲਤ ਵੀਡੀਓ ਤਾਂ ਨਹੀਂ ਵੇਖ ਰਿਹਾ ਜਾਂ ਕੋਈ ਸਨੈਪਚੈਟ ਵਗੈਰਾ 'ਤੇ ਕੁਝ ਕਿਸੇ ਅਨਨੋਨ ਪਰਸਨ ਨਾਲ ਕੋਈ ਗੱਲਾਂ ਤਾਂ ਨਹੀਂ ਕਰ ਰਿਹਾ ਇਹੋ ਜਿਹੀਆਂ ਜਿਹੜੀਆਂ ਉਹਨੂੰ ਨਹੀਂ ਕਰਨੀਆਂ ਚਾਹੀਦੀਆਂ ਸੋ ਜਿੰਨੀ ਵੀ ਵਰਤੋਂ ਹੋਵੇ ਮੋਬਾਇਲ ਦੀ ਚਾਹੇ ਉਹ ਵਿੱਦਿਅਕ ਖੇਤਰ ਲਈ ਹੋਵੇ ਬੱਚੇ ਕਹਿੰਦੇ ਤਾਂ ਹੈਗੇ ਪੜ੍ਹਨ ਲਈ ਲਿਆ ਪਰ ਪੜ੍ਹਦੇ ਨਹੀਂ ਸੋ ਭਾਵੇਂ ਵਿੱਦਿਆ ਲਈ ਉਹ ਫੋਨ ਫੜਨ ਚਾਹੇ ਗੇਮਾਂ ਲਈ ਫੋਨ ਫੜਨ ਜਾਂ ਕਿਸੇ ਹੋਰ ਵੀਡੀਓ ਵਗੈਰਾ ਵੇਖਣ ਲਈ ਹਮੇਸ਼ਾ ਉਹ ਮਾਪਿਆਂ ਦੀ ਨਿਗਰਾਨੀ ਹੇਠ ਹੋਣਾ ਚਾਹੀਦਾ ਜੇ ਮਾਪੇ ਨਿਗਰਾਨੀ ਨਹੀਂ ਕਰ ਸਕਦੇ ਅਤੇ ਫਿਰ ਬੱਚਿਆਂ ਨੂੰ ਜਿਹੜਾ ਆ ਉਹ ਨੈੱਟ ਵਾਲਾ ਮੋਬਾਇਲ ਜ਼ਿਆਦਾਤਰ ਨਹੀਂ ਦੇਣਾ ਚਾਹੀਦਾ ਬਸ ਇਸ ਤਰ੍ਹਾਂ ਬੱਚਿਾਆਂ ਦੀ ਦੇਖਭਾਲ ਕਰ ਸਕਦੇ ਹਾਂ